ਜਿਵੇਂ ਕਿ ਅਸੀਂ ਜਾਣਦੇ ਹਾਂ ਕਿ ਪਿਛਲੇ ਕਈ ਸਾਲਾਂ ਤੋਂ ਆਪਣੇ ਦੇਸ਼ ਦੇ ਵਿੱਚ ਅਪਰਾਧ ਹਨ ਜੋ ਬਹੁਤ ਜ਼ਿਆਦਾ ਵੱਧ ਰਹੇ ਹਨ ਅਤੇ ਇੱਕ ਇਕੱਲੇ ਵਿਅਕਤੀ ਲਈ ਉਸ ਦੀ ਸੁਰੱਖਿਆ ਦਿਨ ਵ ਦਿਨ ਘੱਟਦੀ ਜਾ ਰਹੀ ਹੈ ਅਪਰਾਧ ਵੱਧਣ ਦੇ ਬਹੁਤ ਸਾਰੇ ਕਾਰਣ ਹਨ ਜਿਵੇਂ ਬੇਰੁਜ਼ਗਾਰੀ ਪੁਲਿਸ ਦੇ ਮੁਲਾਜ਼ਮਾਂ ਦੀ ਕਮੀ ਸਰਕਾਰ ਵੱਲੋਂ ਜ਼ਿਆਦਾ ਸਖ਼ਤ ਕਾਨੂੰਨ ਨਾ ਬਣਾਏ ਗਏ ਹਨ ਤਾਂ ਆਪਾਂ ਜਿਵੇਂ ਗੱਲ ਕਰ ਸਕਦੇ ਹਾਂ ਬੇਰੁਜ਼ਗਾਰੀ ਦੀ ਜਿਵੇਂ ਕਿ ਨੌਜਵਾਨ ਜਦੋਂ ਕਮਾਉਂਦਾ ਨਹੀਂ ਹੈ ਤਾਂ ਉਹ ਪੈਸੇ ਕਮਾਉਣ ਲਈ ਕੋਈ ਹੋਰ ਰਸਤਾ ਚਾਹੁੰਦਾ ਹੈ ਤਾਂ ਉਹਨਾਂ ਵਿੱਚੋਂ ਕਈ ਵਾਰ ਨੌਜਵਾਨ ਅਪਰਾਧ ਕਰਨ ਦਾ ਰਸਤਾ ਵੀ ਚੁਣ ਲੈਂਦੇ ਹਨ ਤਾਂ ਸਰਕਾਰ ਨੂੰ ਚਾਹੀਦਾ ਹੈ ਕਿ ਵੱਧ ਤੋਂ ਵੱਧ ਨੌਜਵਾਨਾਂ ਨੂੰ ਨੌਕਰੀ ਦਿੱਤੀ ਜਾਵੇ ਤਾਂ ਜੋ ਨੌਜਵਾਨ ਸ ਸਹੀ ਰਸਤੇ 'ਤੇ ਤੁਰ ਕੇ ਦੇਸ਼ ਨੂੰ ਸਹੀ ਰਸਤੇ ਸਹੀ ਦਿਸ਼ਾ ਵਿੱਚ ਲੈ ਕੇ ਜਾ ਸਕਣ ਪੁਲਿਸ ਮੁਲਾਜ਼ਮਾਂ ਨੂੰ ਵੀ ਚਾਹੀਦਾ ਹੈ ਕਿ ਸਹੀ ਸਮੇਂ 'ਤੇ ਜਦੋਂ ਅਪਰਾਧ ਹੁੰਦਾ ਹੈ ਤਾਂ ਉੱਥੇ ਪਹੁੰਚ ਸਕਣ ਅਤੇ ਅਪਰਾਧ ਨੂੰ ਜਮਾ ਸ਼ੁਰੂ ਤੋਂ ਹੀ ਕੰਟਰੋਲ ਕੀਤਾ ਜਾ ਸਕੇ ਤਾਂ ਜੋ ਇਹ ਛੋਟੇ ਛੋਟੇ ਅਪਰਾਧ ਹੁੰਦੇ ਵੱਡੇ ਅਪਰਾਧ ਨਾ ਬਣਨ ਆਪਾਂ ਨੂੰ ਆਪਾਂ ਕਈ ਵਾਰ ਖੁਦ ਵੀ ਕਾਨੂੰਨ ਹੱਥ ਵਿੱਚ ਲੈ ਲੈਂਦੇ ਹਾਂ ਉਹ ਵੀ ਗੱਲ ਗਲਤ ਹੈ ਆਪਾਂ ਨੂੰ ਕਾਨੂੰਨ ਹੱਥ ਵਿੱਚ ਵੀ ਨਹੀਂ ਲੈਣਾ ਚਾਹੀਦਾ ਪਰ ਕਦੇ ਅਪਰਾਧ ਹੁੰਦਾ ਦੇਖ ਕੇ ਉਸ ਨੂੰ ਵੇ ਨਜ਼ਰ ਵੀ ਨਹੀਂ ਕਰਨਾ ਚਾਹੀਦਾ ਜਦੋਂ ਅਪਰਾਧ ਹੁੰਦਾ ਹੈ ਤਾਂ ਆਪਾਂ ਨੂੰ ਉਸ ਵਿੱਚ ਤੁਰੰਤ ਪੁਲਿਸ ਨੂੰ ਖ਼ਬਰ ਕਰਨੀ ਚਾਹੀਦੀ ਹੈ ਅਤੇ ਤਾਂ ਜੋ ਉਸ ਨੂੰ ਕਾਨੂੰਨੀ ਦਾਇਰੇ ਵਿੱਚ ਰਹਿ ਕੇ ਹੀ ਸਮੇਟਿਆ ਜਾ ਸਕੇ ਇਸ ਲਈ ਸਾਨੂੰ ਚਾਹੀਦਾ ਹੈ ਕਿ ਸਰਕਾਰ ਅਤੇ ਆਪਾਂ ਨਾ ਮਿਲ ਕੇ ਅਪਰਾਧ ਨੂੰ ਘੱਟ ਕਰੀਏ ਤਾਂ ਜੋ ਆਪਣਾ ਦੇਸ਼ ਖੁਸ਼ਹਾਲ ਰਹਿ ਸਕੇ ਅਤੇ ਅਪ ਅਪਰਾਧ ਮੁਕਤ ਹੋ ਸਕੇ